ਹਾਂਜੀ ਅਸੀਂ ਜੈ ਮਾਂ ਜਗਦੰਬੇ ਸੇਵਾ ਸਮਿਤੀ ਦੇ ਮੈਂਬਰ ਹਾਂ ਜੀ ਜਿਹਦੇ ਵਿੱਚੋਂ ਲਗਭਗ ਅਸੀਂ ਦਸ ਬੰਦੇ ਜੁੜੇ ਸੀ ਆਪਣੇ ਅੱਜ ਕਮ ਸੇ ਕਮ ਸੱਤਰ ਅੱਸੀ ਬੰਦੇ ਸਾਡੇ ਨਾਲ ਜੁੜੇ ਦੇ ਆ ਜਿਹਦੇ ਵਿੱਚੋਂ ਸਾਡਾ ਫੰਡ ਇਕੱਠਾ ਹੁੰਦਾ ਅਤੇ ਜਿਹੜਾ ਫੰਡ ਅਸੀਂ ਇਕੱਠਾ ਕਰਕੇ ਜੋ ਵੀ ਕਿਸੇ ਜ਼ਰੂਰਤਮੰਦ ਬੰਦੇ ਨੂੰ ਕਿਸੇ ਕੁੜੀ ਦਾ ਵਿਆਹ ਹੋਵੇ ਜਾਂ ਵਰਦੀਆਂ ਦੇਣੀਆਂ ਹੋਣ ਸਕੂਲਾਂ 'ਚ ਜਾਂ ਕੋਈ ਹੋਸਪੀਟਲ 'ਚ ਫਰੂਟ ਵੰਡਣਾ ਹੋਵੇ ਇਹ ਜਿੰਨਾ ਵੀ ਪੈਸਾ ਇਕੱਠਾ ਹੁੰਦਾ ਇਹ ਫੰਡ ਅਸੀਂ ਇਸ ਤਰ੍ਹਾਂ ਸਕੂਲਾਂ 'ਚ ਅਤੇ ਹੋਰ ਜ਼ਰੂਰਤਮੰਦ ਬੰਦਿਆਂ ਨੂੰ ਦਿੰਦੇ ਹਾਂ ਜੀ ਜਿਹਦੇ ਵਿੱਚੋਂ ਇੱਕ ਮਾਤਾ ਦਾ ਜਗਰਾਤਾ ਸਾਲ ਬਾਅਦ ਔਰ ਲੰਗਰ ਪਾਣੀ ਹੁੰਦਾ ਜੀ ਜਿਹਦੇ ਵਿੱਚੋਂ ਸਾਡੇ ਨਾਲ ਰਹਿਣ ਵਾਲੇ ਥੋੜ੍ਹੇ ਜਿਹੇ ਠੀਕ ਬੰਦੇ ਨੇ ਅਮੀਰ ਬੰਦੇ ਨੇ ਬਹੁਤ ਵਧੀਆ ਸਹਿਯੋਗ ਦਿੰਦੇ ਨੇ ਜਿਹਦੇ ਵਿੱਚੋਂ ਦਸ ਦਸ ਹਜ਼ਾਰ ਰੁਪਿਆ ਤੁਹਾਨੂੰ ਦਸ ਬੰਦੇ ਦਾ ਸਹਿਯੋਗ ਮਿਲ ਜਾਂਦਾ ਹੈ ਜਿਸ 'ਚ ਲੱਖ ਰੁਪਇਆ ਸਾਡਾ ਉਹਨਾਂ ਦਾ ਇਕੱਠਾ ਹੋ ਜਾਂਦਾ ਬਾਕੀ ਬਹੁਤ ਹੀ ਵਧੀਆ ਔਰ ਚੰਗੇ ਬੰਦੇ ਜੁੜੇ ਦੇ ਨੇ ਜਿਹੜੇ ਦਿਲ ਲਾ ਕੇ ਸੇਵਾ ਕਰਦੇ ਨੇ ਇਸ ਲਈ ਕੋਈ ਵੀ ਕਲੱਬ ਨਾਲ ਜੁੜਨਾ ਚਾਹੀਦਾ ਔਰ ਸੇਵਾ ਭਾਵਨਾ ਦਾ ਮਾਤਾ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ